ਪੰਜਾਬ ਵਿੱਚ ਸਰਕਾਰੀ ਸਿਹਤ ਸੰਭਾਲ ਜਿਹੜੀ ਪ੍ਰਣਾਲੀ ਹੈ ਕੋਈ ਇੰਨੀ ਅਫੈਕਟਿਵ ਨਹੀਂ ਹੈਗੀ ਜੋ ਮੈਂ ਮਹਿਸੂਸ ਕਰਦੀ ਹਾਂ ਪਰਸਨਲੀ ਕਿਉਂਕਿ ਇੱਥੇ ਮਤਲਬ ਜਦੋਂ ਅਸੀਂ ਹੋਸਪਿਟਲਾਂ 'ਚ ਜਾਂਦੇ ਹਾਂ ਤਾਂ ਇੱਕ ਤਾਂ ਪੇਸ਼ੈਂਟ ਦੀ ਸਹੀ ਤਰ੍ਹਾਂ ਢੰਗ ਨਾਲ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ ਪਹਿਲੀ ਗੱਲ ਡੋਕਟਰ ਸਾਰੇ ਅਵੇਲੇਬਲ ਨਹੀਂ ਹੁੰਦੇ ਆ ਦੂਸਰੀ ਗੱਲ ਦਵਾਈਆਂ ਵਗੈਰਾ ਉੱਥੋਂ ਨਹੀਂ ਮਿਲਦੀਆਂ ਢੰਗ ਨਾਲ ਜਿਹੜੀਆਂ ਹੈਗੀਆਂ ਅਤੇ ਇਸ ਤੋਂ ਇਲਾਵਾ ਮ ਜਰ ਜਿਵੇਂ ਬਾਕੀ ਦੇਸ਼ਾਂ ਦਾ ਸੁਣਿਆ ਮੈਂ ਸਿਸਟਮ ਜਿਵੇਂ ਗੱਲ ਚੱਲਦੀ ਹੈ ਤਾਂ ਉੱਥੇ ਲ ਪ੍ਰਿਓਰਟੀ ਦਿੱਤੀ ਜਾਂਦੀ ਆ ਬੰਦੇ ਨੂੰ ਅਤੇ ਮੈਡੀਕਲ ਫ੍ਰੀ ਹੈ ਔਰ ਬੰਦੇ ਦੀ ਸਾਂਭ ਸੰਭਾਲ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ ਸੋ ਇੱਥੇ ਮੈਂ ਤਾਂ ਮਹਿਸੂਸ ਕਰਦੀ ਇੱਥੇ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ ਜਦੋਂ ਕੋਈ ਪ੍ਰੋਬਲਮ 'ਚ ਜਾਂਦਾ ਵੀ ਆ ਹੋਸਪਿਟਲ ਅਤੇ ਦੂਸਰੀ ਗੱਲ ਹੈ ਕਿ ਮ ਇੱਥੇ ਜਿਹੜੇ ਹੋਸਪਿਟਲ ਆ ਜਿਵੇਂ ਦਵਾਈਆਂ ਵਗੈਰਾ ਫ੍ਰੀ ਹੋਣੀਆਂ ਚਾਹੀਦੀਆਂ ਉਹ ਨਹੀਂ ਮਿਲਦੀਆਂ ਹੈਗੀਆਂ ਬਾਹਰ ਤਾਂ ਟੋਟਲੀ ਸਾਰਾ ਕੁਛ ਫ੍ਰੀ ਹੈ ਸੋ ਮੈਂ ਸਮਝਦੀ ਹਾਂ ਕਿ ਇਨ੍ਹਾਂ ਨੂੰ ਇਹਨਾਂ ਵਿੱਚ ਸੁਧਾਰ ਕੀਤਾ ਜਾਣਾ ਚਾਹੀਦਾ ਆ ਤਾਂ ਕਿ ਜਿਹੜੇ ਮ ਸਾਡੇ ਮੁੱਢਲੇ ਹੱਕ ਹੈ ਜਿਵੇਂ ਵਿੱਦਿਆ ਹੋ ਗਈ ਜਾਂ ਮੈਡੀਕਲ ਹੈ ਇਹ ਹਮੇਸ਼ਾਂ ਫ੍ਰੀ ਔਰ ਟੋਪ ਪ੍ਰਿਓਰਟੀ 'ਤੇ ਹੋਣੇ ਚਾਹੀਦੇ ਆ